ਵੈਸੇ ਤਾਂ ਜੇਕਰ ਅਸੀਂ ਗੱਲ ਕਰੀਏ ਤਾਂ ਬਹੁਤ ਸਾਰੇ ਧਾਰਮਿਕ ਤਿਉਹਾਰ ਮਨਾਏ ਜਾਂਦੇ ਹਨ ਪ੍ਰੰਤੂ ਜੇਕਰ ਲੋਹੜੀ ਦੀ ਗੱਲ ਕਰੀਏ ਤਾਂ ਲੋਹੜੀ ਇਹਨਾਂ ਵਿੱਚੋਂ ਇੱਕ ਬਹੁਤ ਹੀ ਮਹੱਤਵਪੂਰਨ ਤਿਉਹਾਰ ਹੈ ਇਸ ਦੇ ਵਿੱਚ ਹੋਲੀਕਾ ਨੂੰ ਜਦੋਂ ਅਸੀਂ ਅਗਨੀ ਭੇਟ ਕਰਦੇ ਹਾਂ ਤਾਂ ਉਸ ਦੇ ਸਮੇਂ ਅਸੀਂ ਉਸ ਵਿੱਚ ਤਿਲ ਗੇਰਦੇ ਹਾਂ ਅਤੇ ਮੂੰਗਫਲੀਆਂ ਰੇਕਓੜੀਆਂ ਰੇਓੜੀਆਂ ਅਤੇ ਗੱਚਕ ਆਦਿ ਖਾਂਦੇ ਹਾਂ ਇਸ ਦੇ ਨਾਲ਼ ਇਹ ਤਿਉਹਾਰਾਂ ਵਿੱਚ ਬਹੁਤ ਹੀ ਖਾਸ ਹੁੰਦਾ ਹੈ ਰੇਓੜੀਆਂ ਅਤੇ ਮੂੰਗਫਲੀਆਂ ਇਸ ਵਿੱਚ ਬਹੁਤ ਹੀ ਖਾਸ ਮੰਨੇ ਜਾਂਦੇ ਹਨ